ਹੈਲੋ ਸਤਿ ਸ਼੍ਰੀ ਅਕਾਲ ਤੁਸੀਂ ਬਿੱਟੂ ਸ਼ੂਜ਼ ਹਾਊਸ ਤੋਂ ਬੋਲ ਰਹੇ ਹੋ ਸਰ ਮੇ ਮੇਰੀ ਨਾ ਕਜ਼ਨ ਦੀ ਮੈਰਿਜ ਸੀ ਉਹਦੇ ਲਈ ਮੈਨੇ ਫੁੱਟਵੇਅਰ ਲੈਣੇ ਸੀਗੇ ਜੈਂਟਸ ਔਰ ਲੇਡੀਸ ਦੋਨੇ ਲੈਣੇ ਸੀਗੇ ਤੁਹਾਡੇ ਕੋਲ ਕਿਹੜੇ ਮਿਲ ਜਾਣਗੇ ਫੈਂਸੀ 'ਚ ਮਿਲ ਜਾਣਗੇ ਸਰ ਕਿਆ ਨੰਬਰ ਕਿਸ ਨੰਬਰ ਤੋਂ ਸ ਸਾਈਜ ਸਟਾਰਟ ਹੋਏਗਾ ਸ਼ੂਜ਼ ਦਾ ਓ ਓਕੇ ਸਰ ਸਰ ਪਾਰਟੀ ਵੀਅਰ ਵੀ ਮਿਲ ਜਾਣਗੇ ਕੈਜ਼ੂਅਲ ਵੀ ਮਿਲ ਜਾਣਗੇ ਲੇਡੀਜ ਵਿੱਚ ਹਾਂਜੀ ਲੇਡੀਜ ਦੇ ਵਿੱਚ ਕਿਹੜੇ ਕਿਹੜੇ ਮਿਲ ਜਾਣਗੇ ਸਟਾਰਟਿੰਗ ਸਾਈਜ ਕੀ ਮਿਲੇਗਾ ਜਿਵੇਂ ਫਲੈ ਫਲੈਟਸ ਵੀ ਮਿਲ ਜਾਣਗੀਆਂ ਹੀਲਸ ਵੀ ਮਿਲ ਜਾਣਗੇ ਹਾਈ ਹੀਲਸ ਵੀ ਮਿਲ ਜਾਣਗੀਆਂ ਸਰ ਬੂਟ ਵਗੈਰਾ ਸਪੋਰਟ ਸ਼ੂਜ਼ ਵਗੈਰਾ ਸਭ ਕੁਛ ਮਿਲ ਜਾਏਗਾ ਸਰ ਜੈਂਟਸ ਵਿੱਚ ਵੀ ਸਭ ਮਿਲ ਜਾਏਗਾ ਲੈਦਰ ਸ਼ੂਜ ਵਗੈਰਾ ਲੇਸਿਸ ਵਾਲੇ ਬਿਨਾਂ ਲੇਸਿਸ ਵਾਲੇ ਅਤੇ ਜੈਂਟਸ ਵਿੱਚ ਸਟਾਟਿੰਗ ਪ੍ਰਾਈਜ਼ ਕੀ ਹੋਏਗਾ ਤੁਹਾਡਾ ਸ਼ੂਜ਼ ਦਾ ਓ ਉ ਓਕੇ ਸਰ ਸਰ ਤੁਹਾਡੀ ਸ਼ੋਪ ਦੀ ਟਾਈਮਿੰਗ ਕੀ ਹੈ ਓਕੇ ਸਰ ਮੈਂ ਤੁਹਾਡੇ ਕੋਲ ਜਲਦੀ ਵਿਜਿਟ ਕਰਾਂਗੀ ਤੁਸੀਂ ਮੈਨੂੰ ਆਪਣੇ ਵਟਸਐਪ 'ਤੇ ਕੁਛ ਫੋਟੋਜ਼ ਵਗੈਰਾ ਭੇਜ ਸਕਦੇ ਹੋ ਪਾਰਟੀ ਵੀਅਰ ਲੇਡੀਜ ਸ਼ੂਜ ਵਗੈਰਾ ਯਾਂ ਸ਼ੂਜ਼ ਵ ਹਾਂਜੀ ਤੁਸੀਂ ਮੈਨੂੰ ਆਪਣੀ ਹਾਂਜੀ ਲੋਕੇਸ਼ਨ ਸ਼ੇਅਰ ਕਰਦੋ ਮੈਨੂੰ ਵਟਸਐਪ 'ਤੇ ਅਤੇ ਫਿਰ ਮੈਂ ਤੁਹਾਡੇ ਕੋਲ ਜਲਦੀ ਵਿਜਿਟ ਕਰਾਂਗੀ ਅਤੇ ਉਹਦੇ ਵਿੱਚ ਮੈਂ ਆਪਣੀ ਕਜ਼ਨ ਦੇ ਮੈਰਿਜ ਦੇ ਲਈ ਲੇਡੀਜ ਔਰ ਜੈਂਟਸ ਦੋਨੇ ਫੁੱਟ ਵੇਅਰ ਲੈਣੇ ਅਤੇ ਫਿਰ ਮੈਂ ਤੁਹਾਡੀ ਸ਼ੋਪ 'ਤੇ ਜਲਦੀ ਹੀ ਵਿਜਿਟ ਕਰਾਂ ਠੀਕ ਹੈ ਸਰ ਓਕੇ